ਪਰਿਵਾਰ ਦੇ ਹਰੇਕ ਮੈਂਬਰ ਦੀ ਲੋੜ ਹੀ ਸਾਡੀ ਸ਼ਕਤੀ ਹੁੰਦੀ ਹੈ ਜਦੋਂ ਵੀ ਪਰਿਵਾਰ ਦੇ ਮੁਖੀ 'ਤੇ ਕੋਈ ਭੀੜ ਪੈਂਦੀ ਹੈ ਤਾਂ ਪਰਿਵਾਰ ਹੀ ਸਭ ਤੋਂ ਪਹਿਲਾਂ ਉਸ ਦੇ ਨਾਲ ਉਸ ਮੁਸ਼ਕਿਲ ਵਿੱਚ ਖੜਦਾ ਹੈ ਜੋ ਕਿ ਹਰੇਕ ਮੁਸ਼ਕਿਲ ਨੂੰ ਦੂਰ ਕਰਨ ਲਈ ਸਹਾਈ ਹੁੰਦਾ ਹੈ ਅਤੇ ਵੱਡੀ ਸ਼ਕਤੀ ਬਣ ਕੇ ਉੱਭਰਦਾ ਹੈ ਕਮਜ਼ੋਰੀਆਂ 'ਚੋਂ ਹਨ ਉਹ ਪਰਿਵਾਰ ਦਾ ਪਿਆਰ ਅਤੇ ਹੋਰ ਲੋਕਾਂ ਦਾ ਸਾਥ ਠੀਕ ਲੋਕਾਂ ਦਾ ਹੈ ਜੋ ਕਿ ਸਾਡੇ ਲਈ ਕਈ ਵਾਰੇ ਕਮਜ਼ੋਰੀ ਵੀ ਬਣ ਜਾਂਦਾ ਹੈ